ਪਕਵਾਨਾਂ ਨੂੰ ਲੈ ਕੇ ਜੇਕਰ ਤਾਂ ਗੱਲ ਕਰੀਏ ਤਾਂ ਸਾਰੇ ਪਕਵਾਨ ਬਣਾਉਣੇ ਅੱਜ ਕੱਲ ਦੇ ਸਮੇਂ ਵਿੱਚ ਤਾਂ ਈਜ਼ੀ ਹੋ ਚੁੱਕਿਆ ਅੱਜ ਕੱਲ ਦੇ ਨਵੇਂ ਨਵੇਂ ਪ੍ਰਕਾਰ ਦੇ ਪਕਵਾਨ ਚੱਲ ਚੁੱਕੇ ਹਨ ਪਹਿਲੇ ਸਮੇਂ ਵਿੱਚ ਤਾਂ ਲੋਕ ਜ਼ਿਆਦਾ ਕੋਈ ਸੁੱਕੀਆਂ ਸਬਜ਼ੀਆਂ ਕੋਈ ਦਾਲਾਂ ਵਗੈਰਾ ਇਹ ਚੀਜ਼ਾਂ ਖਾਂਦੇ ਸਨ ਪਰ ਅੱਜ ਕੱਲ ਦੇ ਸਮੇਂ ਵਿੱਚ ਤਾਂ ਬਹੁਤ ਤਰ੍ਹਾਂ ਦੀਆਂ ਪਕਵਾਨ ਚੱਲ ਪਏ ਨੇ ਜਿੱਦਾਂ ਬੱਚਿਆਂ ਦੇ ਵਿੱਚ ਬੱਚੇ ਪਸੰਦ ਕਰਦੇ ਨੇ ਡੋਸਾ ਵਗੈਰਾ ਹੋ ਗਿਆ ਪਾਸਤਾ ਹੋ ਗਿਆ ਮੈਗੀ ਵਗੈਰਾ ਹੋ ਗਈ ਇਹ ਚੀਜ਼ਾਂ ਅੱਜ ਕੱਲ ਦੇ ਬੱਚੇ ਜ਼ਿਆਦਾ ਪਸੰਦ ਕਰਦੇ ਜੋ ਕਿ ਜਲਦੀ ਵੀ ਤਿਆਰ ਹੋ ਜਾਂਦੇ ਨੇ ਬੱਚੇ ਵੀ ਖੁਸ਼ ਹੋ ਜਾਂਦੇ ਨੇ ਖਾ ਕੇ ਜੋ ਕਿ ਮੂੰਹ ਨੂੰ ਇੱਕ ਇੱਦਾਂ ਦਾ ਸਵਾਦ ਚੜ੍ਹਾ ਲਗਾ ਦਿੱਤੇ ਦਾ ਹੈ ਲੱਗ ਗਿਆ ਹੈ ਜਿਸ ਕਰਕੇ ਬੱਚੇ ਚਾਹੁੰਦੇ ਨੇ ਕਿ ਸਾਨੂੰ ਡੇਲੀ ਮੈਗੀ ਪਾਸਤਾ ਇਹ ਚੀਜ਼ਾਂ ਦਾ ਵਰਣਨ ਕੀਤਾ ਸਾਨੂੰ ਦਿੱਤਾ ਜਾਵੇ ਪਿਛਲੇ ਸਮੇਂ 'ਚ ਤਾਂ ਅਸੀਂ ਇਹ ਚੀਜ਼ਾਂ ਦਾ ਇੰਨਾ ਵਰਤੋਂ ਕੀਤੀ ਨਹੀਂ ਹੈ ਕਿ ਜੋ ਕਿ ਸਾਨੂੰ ਇੰਨਾ ਪਤਾ ਅੱਜ ਕੱਲ ਤਾਂ ਇਹੋ ਜਿਹੀਆਂ ਚੀਜ਼ਾਂ ਚੱਲ ਪਈਆਂ ਮੈਦੇ ਵਾਲੀਆਂ ਜੋ ਕਿ ਸਾਨੂੰ ਬਣਾਉਣ 'ਚ ਤਾਂ ਈਜ਼ੀ ਨੇ ਪਰ ਖਾਣ 'ਚੋਂ ਉਹ ਸਾਡੇ ਸਰੀਰ ਨੂੰ ਤੰਗੀ ਵੀ ਦੇ ਰਹੀਆਂ ਨੇ ਇਸ ਕਰਕੇ ਅਸੀਂ ਸਾਦਾ ਭੋਜਨ ਪਿਛਲੇ ਸਮੇਂ ਵਿੱਚ ਅਸੀਂ ਸਾਦਾ ਭੋਜਨ ਖਾਣਾ ਪਸੰਦ ਕਰਦੇ ਸੀ ਜੋ ਕਿ ਸਾਡੇ ਸਰੀਰ ਲਈ ਬੈਨੀਫਿਟ ਵੀ ਦਿੰਦੇ ਸਨ ਪਰ ਅੱਜ ਕੱਲ ਤਾਂ ਹ ਜ਼ਿਆਦਾਤਰ ਚੀਜ਼ਾਂ ਮੈਦੇ ਵਾਲੀਆਂ ਚੱਲ ਚਕ ਚੱਲ ਚੁੱਕੀਆਂ ਨੇ ਜਿਹੜੇ ਕਿ ਸਾਡੇ ਬੱਚੇ ਵੀ ਪਸੰਦ ਕਰਦੇ ਨੇ ਉਹ ਬੱਚੇ ਖਾਂਦੇ ਵੀ ਨੇ ਅੱਜ ਕੱਲ ਦੇ ਸਮੇਂ 'ਚ ਬੱਚੇ ਹਰੀਆਂ ਸਬਜ਼ੀਆਂ ਨੂੰ ਅਵੋਇਡ ਕਰ ਰਹੇ ਨੇ ਜੋ ਕਿ ਸਿਹਤ ਲਈ ਬਿਲਕੁਲ ਵੀ ਸਹੀ ਨਹੀਂ ਹੈ ਵਧੀਆ ਸਬਜ਼ੀਆਂ ਦੇ ਵਿੱਚ ਅਸੀਂ ਤਾਂ ਜਿਆਦਾਤਰ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ਪਰ ਸਾਡੇ ਬੱਚੇ ਜੋ ਕਿ ਹੈ ਅੱਜ ਕੱਲ ਦੇ ਉਹ ਮੈਦਾ ਵਗੈਰਾ ਖਾਣਾ ਪਸੰਦ ਕਰਦੇ ਹਨ ਜੋ ਕਿ ਸਾਡੇ ਹਿਸਾਬ ਨਾਲ ਕਿ ਵਧੀਆ ਨਹੀਂ ਹਨ ਜੋ ਕਿ ਸਾਡੇ ਸਰੀਰ ਨੂੰ ਅੱਗੇ ਜਾ ਕੇ ਨੁਕਸਾਨ ਕਰਦੀਆਂ ਹਨ